ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਅੱਛਾ ਜੀ ਦੇਖੋ ਜੀ ਇੱਥੇ ਤਿਉਹਾਰ ਤਾਂ ਸਾਰੇ ਹੀ ਮਨਾਉਂਦੇ ਆ ਜਿਵੇਂ ਦਿਵਾਲੀ ਲੋਹੜੀ ਤਾਂ ਸਾਰਾ ਕੁਝ ਹੁੰਦਾ ਹੀ ਹੈ ਅਤੇ ਇੱਥੋਂ ਦਾ ਜੋ ਇਤਿਹਾਸ ਹੈ ਇੱਥੇ ਸਭ ਤੋਂ ਜ਼ਿਆਦਾ ਆਪਾਂ ਇਹ ਮਾਘੀ ਦੇ ਮੇਲੇ ਦਾ ਮਨਾਉਂਦੇ ਹਾਂ ਹਾਂਜੀ ਮਾਘੀ ਹਾਂਜੀ ਹਾਂਜੀ ਇੱਥੇ ਮ ਮਤਲਬ ਇੱਕ ਤਾਂ ਚਾਲ੍ਹੀ ਮੁਕਤਿਆਂ ਦਾ ਜੀ ਆਪਣਾ ਟੋਟੇਗੰਡੀ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਹੋਣੀ ਬਦਾਵਾ ਦੇ ਕੇ ਆਏ ਸੀ ਗੁਰੂ ਸਾਹਿਬ ਨੂੰ ਬੀ ਨਾ ਤੂੰ ਸਾਡਾ ਗੁਰੂ ਨਾਂ ਅਸੀਂ ਤੇਰੇ ਸਿੱਖ ਜੰਗਲ ਜਿੱਦਾਂ ਦਾ ਟਾਈਮ ਸੀਗਾ ਅਤੇ ਉਦੋਂ ਇਹ ਆ ਗਏ ਸੀ ਅਤੇ ਫਿਰ ਜਿਹੜੀ ਮਾਤਾ ਭਾਗ ਕੌਰ ਸੀਗੀ ਉਹਨੇ ਫਿਰ ਉਹਦੇ ਅਗਵਾਈ ਕੀਤੀ ਅਤੇ ਉਹਨੇ ਫਿਰ ਉਹਨੂੰ ਕਿਹਾ ਕਿ ਤੁਸੀਂ ਚੂੜੀਆਂ ਪਾ ਲਓ ਅਤੇ ਅਸੀਂ ਜਾਂਦੇ ਹਾਂ ਗੁਰੂ ਸਾਹਿਬ ਕੋਲ ਤੁਸੀਂ ਪਿੱਠ ਦੇ ਕੇ ਆ ਗਏ ਆ ਵੀ ਜੰਗਾਂ ਦਾ ਟਾਈਮ ਸੀਗਾ ਅਤੇ ਉਸ ਤੋਂ ਬਾਅਦ ਫਿਰ ਇੱਥੇ ਜੰਗ ਹੋਈ ਸੀ ਅਤੇ ਉਹ ਭਾਈ ਮਹਾਂ ਸਿੰਘ ਫਿਰ ਸਾਰੇ ਮਾਝੇ ਦੇ ਸਿੰਘਾਂ ਨੂੰ ਨਾਲ ਲੈ ਕੇ ਮਾਤਾ ਭਾਗ ਕੌਰ ਅਤੇ ਫਿਰ ਉਹ ਇੱਥੇ ਜੰਗ ਹੋਇਆ ਸੀਗਾ ਅਤੇ ਉਹ ਟਿੱਬੀ ਸਾਹਿਬ ਜਿਹੜਾ ਜੰਗ ਹੋਇਆ ਉਹ ਟਿੱਬੀ ਸਾਹਿਬ ਹੋਇਆ ਸੀਗਾ ਟਿੱਬੀ ਸਾਹਿਬ ਅਤੇ ਉਸ ਜੰਗ ਜਿੱਤੀ ਮਹਾਰਾਜਾ ਅਤੇ ਇੱਥੇ ਫਿਰ ਜਿਹੜੇ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਜੀ ਫਿਰ ਇਹ ਮ ਮਤਲਬ ਮਹਾਰਾਜ ਜਦੋਂ ਆਏ ਆ ਅਤੇ ਉਹ ਇੱਥੇ ਮਹਾਂ ਸਿੰਘ ਦੇ ਜਿਹੜੇ ਸਵਾਸ ਸੀਗੇ ਉਹ ਥੋੜ੍ਹੇ ਥੋੜ੍ਹੇ ਚਲਦੇ ਸੀ ਬਾਕੀ ਮਤਲਬ ਵੀ ਸਿੰਘ ਸ਼ਹੀਦ ਹੋ ਗਏ ਸੀ ਅਤੇ ਉਹ ਉਹ ਫਿਰ ਇਹਨਾਂ ਨੇ ਮਤਲਬ ਇਹ ਮਹਾਰਾਜ ਨੇ ਕਿਹਾ ਉਹ ਦੱਸ ਮੰਗ ਜੋ ਮੰਗਦਾ ਭਾਈ ਮਹਾਂ ਸਿੰਘਾ ਉਹ ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਮੰਗਦਾ ਮੈਂ ਤਾਂ ਇਹੀ ਮੰਗਦਾ ਵੀ ਜਦੋਂ ਅਸੀਂ ਤੁਹਾਨੂੰ ਬਦਾਵਾ ਦੇ ਕੇ ਆਏ ਸੀ ਉਹ ਬਦਾਵਾ ਤੁਸੀਂ ਪਾੜ ਦਿਓ ਅਤੇ ਮੈਂ ਸਾਡੀ ਮ ਮੁਕਤੀ ਹੋ ਜਾਵੇ ਸਾਡੀ ਉਹ ਫਿਰ ਉੱਥੇ ਇਹ ਭਾਈ ਮਹਾਂ ਸਿੰਘ ਹੋਰੀ ਦੇ ਮਤਲਬ ਕਾ ਚਾਲ੍ਹੀ ਸਿੰਘ ਸ਼ਹੀਦ ਹੋਏ ਸੀਗੇ ਅਤੇ ਉੱਥੇ ਫਿਰ ਜਿਹੜਾ ਇਹਦਾ ਨਾਲ ਹੈਗਾ ਵੀ ਸਿੰਘਾਂ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਹੈ ਅਤੇ ਉਹਦੇ ਵਿੱਚ ਜਿਹੜੇ ਅੰਗੀਠਾ ਚੱਲਿਆ ਗਿਆ ਸੀ ਅਤੇ ਚਾਲ੍ਹੀ ਸਿੰਘਾਂ ਦਾ ਸਸਕਾਰ ਹੋਇਆ ਸੀ ਅਤੇ ਸ਼ਹੀਦਾਂ ਦਾ ਯਾਦਗਾਰ ਬਣੀ ਹੋਈ ਹੈ ਉਹ ਗੁਰਦੁਆਰਾ ਸਾਹਿਬ ਹੈ ਇੱਕ ਵਿੱਚ ਗੁਰੂ ਹੈ ਤੰਬੂ ਸਾਹਿਬ ਜਿੱਥੇ ਇਹਨਾਂ ਨੇ ਤੰਬੂ ਲਾਏ ਸੀਗੇ ਇੱਥੇ ਉਹਨਾਂ ਨੇ ਕਛਹਿਰੇ ਵੱਡੇ ਵੱਡੇ ਕਛਹਿਰੇ ਹੁੰਦੇ ਇਹਨਾਂ ਦੇ ਉਹ ਸੁੱਕਣੇ ਪਾਏ ਸੀਗੇ ਕਛਹਿਰੇ ਅਤੇ ਉਹ ਫਿਰ ਉਹਨਾਂ ਨੂੰ ਇੰਝ ਲੱਗਾ ਵੀ ਇਹਨਾਂ ਨੇ ਤਾਂ ਇਹ ਬੀ ਤੰਬੂ ਲੱਗੇ ਹੋਏ ਜਿਵੇਂ ਹਾਂ ਇਹ ਇਤਿਹਾਸ ਹੈ ਹਾਂਜੀ ਹਾਂਜੀ ਉੱਧਰ ਵੀ ਗੁਰਦੁਆਰਾ ਸਾਹਿਬ ਰਕਾਬ ਸਾਹਿਬ ਗੁਰਦੁਆਰਾ ਅਤੇ ਆਪਣਾ ਟਿੱਬੀ ਸਾਹਿਬ ਗੁਰਦੁਆਰਾ ਅਤੇ ਉੱਥੇ ਰਕਾਬ ਗੰਜ ਗੁਰਦੁਆਰਾ ਜਿੱਥੇ ਘੋੜੇ ਦੀ ਰਕਾਬ ਟੁੱਟੀ ਸੀਗੀ ਹਾਂਜੀ ਠੀਕ ਹੈ ਠੀਕ ਹੈ ਅੱਛਾ ਅੱਛਾ